ਪੰਜਾਬ ਵਿੱਚ ਬਹੁਤ ਹੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪੰਜਾਬ ਵਿੱਚ ਬਹੁਤ ਹੀ ਉਪਭਾਸ਼ਾਵਾਂ ਜਿਵੇਂ ਮਾਝੀ ਦੁਆਬੀ ਦੁਆਬੀ ਪੋਠੋਹਾਰੀ ਅਤੇ ਮਲਵਈ ਬੋਲ ਭਾਸ਼ਾ ਬੋਲੀ ਜਾਂਦੀ ਹੈ ਇਸ ਵਿੱਚ ਪੁਆਧੀ ਭਾਸ਼ਾ ਪੁਆ ਪੁਆਧੇ ਜ਼ਿਲ੍ਹੇ ਵਿੱਚ ਦੁਆਬੀ ਦੁਆਬੇ ਵਿੱਚ ਮਾ ਮਾਲ ਏ ਮ ਮਾਝੀ ਮਾਲਵੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਹਨਾਂ ਭਾਸ਼ਾਵਾਂ ਦਾ ਬੋ ਵਿਕਾਸ ਬਹੁਤ ਹੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਇਹ ਇਸ ਵੀ ਇਹ ਸਾਰੇ ਪਾਸੇ ਵੱਖ ਵੱਖ ਇਲਾਕਾ ਇਲਾਕਿਆਂ ਵਿੱਚ ਅਲੱਗ ਅਲੱਗ ਤਰੀਕਿਆਂ ਨਾਲ਼ ਬੋਲੀਆਂ ਜਾਂਦੀਆਂ ਹਨ ਇਹਨਾਂ ਭਾਸ਼ਾਵਾਂ ਵਿੱਚ ਦਾ ਦੇ ਤੂੰ ਤੇਂ ਮੈਂ ਉਸ ਨੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ ਇਹ ਇਸ ਤਰ੍ਹਾਂ ਪੰਜਾਬ ਵਿੱਚ ਬਹੁਤ ਹੀ ਭ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ